ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਮਾਨ ਸਿੰਘ ਜੇਕਰ ਆਪਾਂ ਗੱਲ ਕਰੀਏ ਖੇਡਾਂ ਦੀ ਤਾਂ ਪੰਜਾਬ ਪਹਿਲੇ ਨੰਬਰ 'ਤੇ ਖੇਡਾਂ ਵਿੱਚ ਪਹਿਲੇ ਨੰਬਰ 'ਤੇ ਹਨ ਇੱਥੋਂ ਹਰ ਇੱਕ ਗੇਮ ਖੇਡਾਂ ਹਰ ਇਕ ਖੇਡ ਖੇਲੀ ਜਾਂਦੀ ਹੈ ਜਿਵੇਂ ਕਿ ਫੁੱਟਬੋਲ ਕ੍ਰਿਕਟ ਵਾਲੀਬੋਲ 'ਤੇ ਜ਼ਿਆਦਾਤਰ ਪਿੰਡਾਂ ਵਿੱਚ ਲੋਕ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕ ਟੂਰਨਾਮੈਂਟ ਕਰਾਉਂਦੇ ਹੈਂ ਜਿਵੇਂ ਕਿ ਛਿੰਝਾਂ ਅਤੇ ਕਬੱਡੀ ਦਾ ਟੂਰਨਾਮੈਂਟ ਕ੍ਰਿਕਟ ਦਾ ਟੂਰਨਾਮੈਂਟ ਇਸਦੇ ਵਿੱਚ ਹਰ ਪਿੰਡਾਂ ਤੋਂ ਸ਼ਹਿਰਾਂ ਤੋਂ ਜਵਾਕ ਬੱਚੇ ਨੇ ਜੋ ਕਿ ਖੇਲਣ ਆਉਂਦੇ ਹਨ ਅਤੇ ਇਨ੍ਹਾਂ ਦਾ ਪਰ ਹੋਰ ਬੱ ਦੂਸਰੇ ਬੱਚਿਆਂ ਨਾਲ ਮੋਹ ਮੁਹੱਬਤ ਵੱਧਦੀ ਹੈ ਅਤੇ ਕੁਝ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ ਜਿਹੜੀਆਂ ਖੇਡਾਂ ਹੈ ਇਹ ਬਹੁਤ ਹੀ ਵਧੀਆ ਬੰਦਿਆਂ ਨੂੰ ਇਹ ਫਿੱਟ ਰੱਖਦੀ ਹੈ ਅਤੇ ਸਾਡੇ ਪੰਜਾਬ ਵਿੱਚ ਇਸ ਦੀ ਸਭ ਤੋਂ ਪਹਿਲੇ ਨੰਬਰ ਖੇਡਾਂ ਨੂੰ ਸਭ ਤੋਂ ਪਹਿਲਾਂ ਨੰਬਰ 'ਤੇ ਰੱਖਿਆ ਜਾਂਦਾ ਹੈ ਅਤੇ ਜੇਕਰ ਗੱਲ ਕਰੀਏ ਆਪਾਂ ਪਿਆਰ ਦੀ ਤਾਂ ਲੋਕ ਖੇਡਾਂ ਨੂੰ ਸਾਡੇ ਵਿੱ ਪੰਜਾਬ ਵਿੱਚ ਬਹੁਤ ਹੀ ਜ਼ਿਆਦਾ ਪਿਆਰ ਦਿੰਦੇ ਹਨ ਅਤੇ ਸਾਡੇ ਪਿੰਡਾਂ ਵਿੱਚ ਛਿੰਝਾਂ ਮੇਲੇ ਲੱਗਦੇ ਹਨ ਜਿੱਥੇ ਬਹੁਤ ਹੀ ਜ਼ਿਆਦਾ ਇਕੱਠ ਹੁੰਦਾ ਹੈ ਅਤੇ ਇੱਥੇ ਗਾਉਣੇ ਬਲ਼ ਗਾਉਣ ਵਾਲੇ ਵੀ ਆਉਂਦੇ ਹਨ ਜਿਨ੍ਹਾਂ ਨੂੰ ਨਿਆਣੇ ਇੱਥੇ ਬਜ਼ੁਰਗ ਬਹੁਤ ਜ਼ਿਆਦਾ ਪਸੰਦ ਕਰਦੇ ਹੈ ਹਨ ਅਤੇ ਸਾਡਾ ਪੰਜਾਬ ਜ਼ਿਆਦਾਤਰ ਇਸ ਦੇ ਨਾਲ਼ ਆਪਾਂ ਲੋਕ ਨਸ਼ੇ ਤੋਂ ਵੀ ਜ਼ਿਆਦਾ ਦੂਰ ਰਹਿ ਸਕਦੇ ਹਨ ਅਤੇ ਇਸਦੇ ਨਾਲ਼ ਲੋਕਾਂ ਨੂੰ ਬਿਮਾਰੀਆਂ ਵੀ ਬਹੁਤ ਹੀ ਘੱਟ ਲੱਗਦੀਆਂ ਹਨ ਜੇਕਰ ਬੱਚੇ ਖੇਡ ਖੇੜਦੇ ਹਨ ਅਤੇ ਲੋਕ ਆਪਸੀ ਗੱਲਬਾਤ ਵੀ ਕਰਦੇ ਹਨ ਅਤੇ ਹਰ ਇੱਕ ਗੇਮ ਦੀ ਲੈਦੀ ਲੈਦੀ ਲੈਦੀ ਟਾਈਮ 'ਤੇ ਸਮੇਂ ਸਮੇਂ 'ਤੇ ਖੇਲੀ ਜਾਂਦੀ ਹੈ ਜੇਕਰ ਠੰਡਾਂ ਦੀ ਤਾਂ ਠੰਡਾਂ ਵਿੱਚ ਜ਼ਿਆਦਾਤਰ ਲੋਕ ਕਬੱਡੀ ਅਤੇ ਫੁੱਟਬੋਲ ਨੂੰ ਜ਼ਿਆਦਾ ਪਸੰਦ ਕਰ ਕਰਦੇ ਹਨ ਜੇਕਰ ਆਪਾਂ ਗਰਮੀਆਂ ਦੀ ਗੱਲ ਕਰੀਏ ਤਾਂ ਤਾਂ ਜਦ ਤੱਕ ਲੋਕ ਕ੍ਰਿਕਟ ਖੇਲਣਾ ਸਾਡੇ ਪਸੰਦ ਕਰਦੇ ਹਨ ਅਤੇ ਇਸ ਦੇ ਸਾਨੂੰ ਬਹੁਤ ਹੀ ਫ਼ਾਇਦੇ ਹਨ ਅਤੇ ਲੋਕ ਹਰ ਤੰਦਰੁਸਤ ਰਹਿੰਦੇ ਹਨ ਅਤੇ ਇੰਨਾ ਖੇਡਣ ਨਾਲ਼ ਲੋਕਾਂ ਨੂੰ ਹਰ ਕੋਈ ਬਿਮਾਰੀ ਤੋਂ ਬਚਦੇ ਹਨ ਅਤੇ ਲੋਕ ਖੇਡਣ ਦੇ ਵਿੱਚ ਲੋਕਾਂ ਦਾ ਪਿਆਰ ਆਪਸੀ ਪਿਆਰ ਵੀ ਵੱਧਦਾ ਹੈ ਅਤੇ ਖੁਸ਼ ਰਹਿੰਦੇ ਹਨ